ਹਾਂ ਅਗਲੀ ਪੀੜ੍ਹੀ ਨੂੰ ਇਤਿਹਾਸ ਪੜ੍ਹਾਉਣਾ ਜ਼ਰੂਰੀ ਹੈ ਕਿਉਂਕਿ ਇਤਿਹਾਸ ਸਾਨੂੰ ਪ੍ਰਾਚੀਨ ਸਮੇਂ ਦੀ ਸਾਡੀ ਸੰਸਕ੍ਰਿਤੀ ਸੱਭਿਅਤਾ ਰਾਜਨੀਤੀ ਸਾਹਿਤ ਭਵਨ ਨਿਰਮਾਣ ਕਲਾ ਆਦਿ ਬਾਰੇ ਗਿਆਨ ਦਿੰਦਾ ਹੈ ਸਾਨੂੰ ਸਾਡੇ ਅਮੀਰ ਵਿਰਸੇ ਦਾ ਪਤਾ ਲੱਗਦਾ ਹੈ ਸਾਡੇ ਗੁਰੂਆਂ ਪੀਰਾਂ ਮਹਾਨ ਸੂਰਮਿਆਂ ਬਾਰੇ ਜਾਣਕਾਰੀ ਮਿਲਦੀ ਹੈ ਮੁਗਲਾਂ ਦੇ ਆਉਣ ਤੋਂ ਪਹਿਲਾਂ ਭਾਰਤੀ ਆਪਣੀ ਸ਼ਿਲਪ ਕਲਾ ਵਿੱਚ ਕਿੰਨੇ ਨਿਪੁੰਨ ਸਨ ਜੇਕਰ ਇਤਿਹਾਸ ਦੀ ਜਾਣਕਾਰੀ ਨਵੀਂ ਪੀੜ੍ਹੀ ਨੂੰ ਦਿੱਤੀ ਜਾਵੇਗੀ ਤਾਂ ਉਹ ਇਤਿਹਾਸ ਦੌਰਾਨ ਕੀਤੀਆਂ ਗਲਤੀਆਂ ਤੋਂ ਸਬਕ ਸਿੱਖਣਗੇ ਇਤਿਹਾਸ ਇਹ ਸਮਝਣ ਵਿੱਚ ਸਹਾਇਕ ਹੁੰਦਾ ਹੈ ਕਿ ਕਿਸ ਪ੍ਰਕਾਰ ਸਮਾਜ ਵਰਤਮਾਨ ਸਵਰੂਪ ਵਿੱਚ ਆਇਆ ਹੈ ਅਸੀਂ ਉਹਨਾਂ ਘਟਨਾਵਾਂ ਦੇ ਘਟਣ ਦੇ ਕਾਰਨਾਂ ਨੂੰ ਸਮਝਣ ਅਤੇ ਵਿਸ਼ਲੇਸ਼ਣ ਕਰਨ ਦੇ ਯੋਗ ਹੋ ਜਾਂਦੇ ਹਾਂ ਜੋ ਯੁੱਗਾਂ ਤੋਂ ਘਟਿਤ ਹੋਈਆਂ ਹਨ ਹਾਂ ਮੈਂ ਆਪਣੇ ਬੱਚਿਆਂ ਨੂੰ ਇਤਿਹਾਸ ਦੀਆਂ ਕਹਾਣੀਆਂ ਸੁਣਾਉਂਦੀ ਹਾਂ